ਹਾਂਜੀ ਮੈਂ ਇਹ ਦੱਸਣ ਲਈ ਤੁਹਾਨੂੰ ਫੋਨ ਕੀਤਾ ਸੀਗਾ ਕਿ ਮੈਂ ਤੁਹਾਡੇ ਕੋਲੋਂ ਇੱਕ ਸਫਾਰੀ ਦਾ ਟਰੋਲੀ ਬੈਗ ਮੰਗਵਾਇਆ ਸੀਗਾ ਕੁਛ ਦਿਨ ਪਹਿਲਾਂ ਜਿਹੜਾ ਕਿ ਮੈਨੂੰ ਰਿਸੀਵ ਹੋਇਆ ਸੀਗਾ ਪਰਸੋਂ ਅਤੇ ਮੈਂ ਉਹਦੇ ਵਿੱਚ ਤੁਹਾਡੇ ਇਹ ਤਰੀਫ਼ ਕਰਨਾ ਚਾਹਵਾਂਗਾ ਕਿ ਜਿਹੜੀ ਡਿਲੀਵਰੀ ਆ ਇਨ ਟਾਈਮ ਸੀਗੀ ਔਰ ਡਿਲੀਵਰੀ ਬੁਆਏ ਦਾ ਐਕਸਪੀਰੀਅੰਸ ਵੀ ਬੜਾ ਬਿਲਕੁਲ ਠੀਕ ਸੀ ਅਤੇ ਈਵਨ ਉਹਨੇ ਉਹਨੂੰ ਇੱਕ ਔਫਰ ਕੀਤੀ ਟਿਪ ਵੀ ਐਕਸੈਪਟ ਨਹੀਂ ਕੀਤੀ ਮਤਲਬ ਉਹਦਾ ਇਤਨਾ ਮਤਲਬ ਅੱਛੇ ਬਿਹੇਵੀਅਰ ਸੀ ਉਹ ਔਰ ਮੇਨਲੀ ਜਿਹੜੀ ਗੱਲ ਹੈ ਕਿ ਜਿਹੜਾ ਟਰੋਲੀ ਬੈਗ ਮੈਨੂੰ ਆਇਆ ਵਿਆ ਮੈਂ ਉਹਤੋਂ ਕਾਫ਼ੀ ਸੰਤੁਸ਼ਟ ਹੈ ਵਾਟਰ ਪਰੂਫ ਹੈ ਡਬਲ ਜ਼ਿਪ ਹੈ ਔਰ ਬੜਾ ਸੇਫ ਹੈ ਜ਼ਿਪ ਮਤਲਬ ਸੇਫਟੀ ਜਿਹੜੀ ਹੈ ਕਾਊਂਟ ਕਰਦੀ ਹੈ ਔਰ ਜਿਹੜੇ ਵਹੀਲ ਮੂਵਮੈਂਟ ਹੈ ਉਹ ਵੀ ਬਹੁਤ ਅੱਛੀ ਹੈ ਔਰ ਅ ਸਾਈਜ਼ ਪਰਫੈਕਟ ਹੈ ਮੈਂ ਬੜਾ ਅੱਛਾ ਇਹਦੇ ਵਿੱਚ ਮੈਂ ਜੋ ਸਮਾਨ ਪਾ ਕੇ ਚੈੱਕ ਕੀਤਾ ਹੈ ਕਿ ਜੋ ਮੇਰੀ ਜ਼ਰੂਰਤ ਸੀ ਮੇਰੀ ਜ਼ਰੂਰਤ ਬਿਲਕੁਲ ਪੂਰੀ ਹੋ ਗਈ ਹੈ ਸਮਾਨ ਬਿਲਕੁਲ ਇਹ 'ਤੇ ਠੀਕ ਆ ਗਿਆ ਅਤੇ ਮੈਨੂੰ ਇਹਨੂੰ ਮੂਵ ਕਰਨ ਵਿੱਚ ਵੀ ਬੜਾ ਕੰਫਰਟੇਬਲ ਹੈ